ਸਾਕਾ ਨੀਲਾ ਤਾਰਾ ਜਾਂ ਅੰਗਰੇਜ਼ੀ ਅਨੁਵਾਦ ਵਿੱਚ ਓਪਰੇਸ਼ਨ ਬਲੂ ਸਟਾਰ ਪੰਜਾਬ ਦੇ ਹਰਿਮੰਦਰ ਸਾਹਿਬ ਦੇ ਅਕਾਲ ਤਖ਼ਤ 'ਤੇ ਉੱਤੇ ਹਮਲਾ ਇਹ ਜੋ ਹਮਲਾ ਹੈ ਉਹ ਇੱਕ ਜੂਨ ਉੱਨੀ ਸੌ ਚੁਰਾਸੀ ਤੋਂ ਲੈ ਕੇ ਦਸ ਜੂਨ ਉੱਨੀ ਸੌ ਚੁਰਾਸੀ ਤੱਕ ਹੋਇਆ ਸੀ ਇਸ ਹਮਲੇ ਵਿੱਚ ਭਾਰਤੀਆਂ ਫੌਜਾਂ ਨੇ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ ਅਤੇ ਜੋ ਅੰਦਰ ਸ਼ਰਧਾਲੂ ਸਨ ਉਹਨਾਂ ਨੂੰ ਜਾਂ ਉਹਨਾਂ ਦਾ ਬਹੁਤ ਕਤਲੇਆਮ ਹੋਇਆ ਹਰਿਮੰਦਰ ਸਾਹਿਬ ਦਾ ਬਹੁਤ ਨੁਕਸਾਨ ਹੋਇਆ ਅਕਾਲ ਤਖ਼ਤ ਨੂੰ ਤਿੱਤਰ ਬਿੱਤਰ ਕਰ ਦਿੱਤਾ ਗਿਆ ਇਹ ਜੋ ਓਪਰੇਸ਼ਨ ਸੀਗਾ ਇਹ ਭਾਰਤੀਏ ਕੇਂਦਰ ਸਰਕਾਰ ਵੱਲੋਂ ਜੋ ਆਤੰਕਵਾਦੀ ਅਕਾਲ ਤਖ਼ਤ ਵਿੱਚ ਛੁਪੇ ਹੋਏ ਸਨ ਉਹਨਾਂ ਨੂੰ ਮਾਰਨ ਜਾਂ ਉਹਨਾਂ ਨੂੰ ਉੱਥੋਂ ਕੱਢਣ ਲਈ ਕੀਤਾ ਗਿਆ ਸੀਗਾ ਇਸ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਚਾਹੇ ਉਹ ਆਪਾਂ ਆਰਥਿਕ ਕਹਿ ਲਈਏ ਚਾਹੇ ਸਮਾਜਿਕ ਕਹਿ ਲਈਏ ਚਾਹੇ ਆਪਾਂ ਧਾਰਮਿਕ ਕਹਿ ਲਈਏ ਜਿੱਦਾਂ ਮਰਜ਼ੀ ਆਪਾਂ ਕਹਿ ਲਈਏ ਇਸ ਵਿੱਚ ਹੰਡਰਡ ਪਰਸੈਂਟ ਪੰਜਾਬ ਦਾ ਨੁਕਸਾਨ ਹੀ ਹੋਇਆ ਸੀ